ਇਸ ਖੇਤਰ ਵਿੱਚ ਸਮੇਂ ਦੇ ਨਾਲ ਹੀ ਧਰਮ ਆ ਜਿਹੜਾ ਬਹੁਤ ਜ਼ਿਆਦਾ ਇਹ 'ਚ ਪਰਿਵਰਤਨ ਆਇਆ ਜਿਵੇਂ ਪੁਰਾਣੇ ਸਮੇਂ ਦੇ ਵਿੱਚ ਸਾਡੇ ਸਿੱਖ ਧਰਮ ਦੇ ਵਿੱਚ ਸਾਰੇ ਲੋਕ ਜ਼ਿਆਦਾਤਰ ਵਿਸ਼ਵਾਸ ਸਾਡੇ ਗੁਰੂਆਂ 'ਤੇ ਕਰਦੇ ਸੀ ਅਤੇ ਉਹ ਜਿਹੜਾ ਵਿਸ਼ਵਾਸ ਆ ਉਹ ਸਾਰੀ ਉਮਰ ਲਈ ਉਹ ਕਾਇਮ ਰੱਖਦੇ ਸੀ ਪਰ ਜਿਹੜੇ ਜੇ ਅੱਜ ਕੱਲ੍ਹ ਦੇ ਜਿਹੜੀ ਸਾਡੀ ਨਵੀਂ ਜਨਰੇਸ਼ਨ ਆ ਜੇ ਉਹਨਾਂ ਦਾ ਇੱਕ ਵੀ ਕੰਮ ਨਹੀਂ ਬਣਦਾ ਤਾਂ ਉਹ ਕੰਮ ਆ ਜਿਹੜਾ ਅਤੇ ਉਹ ਆਪਣੇ ਉਹ ਆਪਣੇ ਗੁਰੂਆਂ 'ਤੇ ਫੇਥ ਛੱਡ ਕੇ ਗੁਰੂਆਂ 'ਤੇ ਵਿਸ਼ਵਾਸ ਛੱਡ ਕੇ ਉਹ ਪੰਡਤਾਂ ਕੋਲ ਪਾਂਧਿਆਂ ਕੋਲ ਜਾਣਾ ਸ਼ੁਰੂ ਕਰ ਦਿੰਦੇ ਨੇ ਉਹਨਾਂ ਕੋਲ ਉਹਨਾਂ ਨੂੰ ਐਂ ਲੱਗਦਾ ਵੀ ਪੰਡਿਤ ਨੇ ਜਿਹੜੇ ਉਹ ਹੀ ਉਨ੍ਹਾਂ ਦੇ ਧਰਮ ਦੇ ਵਿੱਚ ਹੈ ਨਾ ਕੁਝ ਚੇਂਜ ਆ ਉਹਨਾਂ ਦੀ ਜ਼ਿੰਦਗੀ ਵਿੱਚ ਹੋਣ ਵਾਲੇ ਅੱਪ ਐਂਡ ਡਾਊਨ ਨੂੰ ਉਹਨਾਂ ਵਿੱਚ ਚੇਂਜ ਲਿਆ ਸਕਦੇ ਨੇ ਪਰ ਜਦਕਿ ਇਹ ਜਿਹੜਾ ਸਾਡਾ ਧਰਮ ਆ ਇਹਦੇ ਵਿੱਚ ਸਾਨੂੰ ਆਪਣੇ ਧਰਮ ਦੇ ਵਿੱਚ ਬਹੁਤ ਜ਼ਿਆਦਾ ਵਿਸ਼ਵਾਸ ਕਰਨਾ ਚਾਹੀਦਾ ਜੇ ਅਸੀਂ ਵਿਸ਼ਵਾਸ ਕਰਦੇ ਹਾਂ ਤਾਂਹੀਓ ਅਸੀਂ ਆਪਣਾ ਜੀਵਨ ਜਿਹੜਾ ਚੰਗਾ ਉਹ ਬਸਰ ਕਰ ਸਕਦੇ ਹਾਂ